ਮੈਂ ਆਪਣੀ ਦੋੜ ਵਿੱਚ ਸਿਖਲਾਈ ਅਤੇ ਪੋਸ਼ਨ ਨੂੰ ਬਹੁਤ ਹੀ ਜਿਆਦਾ ਮਹੱਤਵਪੂਰਨ ਭੂਮਿਕਾ ਵਿੱਚ ਰੱਖਦਾ ਕਿਉਂਕਿ ਇਹ ਪੋਸ਼ਨ ਹੀ ਹੈ ਜੋ ਸਾਡੇ ਸਰੀਰ ਨੂੰ ਇੱਕ ਚੰਗਾ ਅਤੇ ਦਰੁਸਤ ਰੱਖਦਾ ਕਿਉਂਕਿ ਜੇ ਇੱਕ ਪ੍ਰੋਪਰ ਮਾਤਰ ਵਿੱਚ ਪੋਸ਼ਨ ਲਾਵਾਂਗੇ ਤਾਂ ਹੀ ਭੱਜਣ ਤੇ ਦੌੜਨ ਦਾ ਮਤਲਬ ਨਹੀਂ ਤਾਂ ਭੱਜਣਾ ਨਾ ਭੱਜਣਾ ਇੱਕ ਬਰਾਬਰ ਕਿਉਂਕਿ ਸਰੀਰ ਨੂੰ ਹਰ ਇੱਕ ਪ੍ਰਕਾਰ ਨਿਊਟਰੇਸ਼ਨ ਤੇ ਹਾਈਡਰੇਸ਼ਨ ਦੀ ਜਰੂਰਤ ਹੁੰਦੀ ਹੈ ਜੋ ਕੀ ਮੈਂ ਪਾਣੀ ਵਿੱਚ ਗਲੂਕੋਸ ਦੀ ਮਿਲਾ ਕੇ ਲੈਣਾ ਜਦੋਂ ਮੈਂ ਭੱਜ ਕੇ ਦੌੜ ਕੇ ਆਉਂਦਾ ਤਾਂ ਮੈਂ ਹੁਣ ਸਰ ਇੱਕ ਵੱਡਾ ਗਲਾਸ ਭਰ ਕੇ ਕਿਲੋ ਵਾਲਾ ਗਲੂਕਨ ਡੀ ਪੀਨਾ ਹੈ ਤਾਂ ਕਿ ਮੇਰੇ ਸਰੀਰ ਵਿੱਚ ਹਾਈਡਰੇਸ਼ਨ ਨਾ ਹੋਵੇ ਤੇ ਮੈਂ ਤੇ ਮੈਂ ਪਾਣੀ ਵੀ ਪ੍ਰੋਪਰ ਮਾਤਰ ਵਿੱਚ ਪੀਨਾ ਜਿਆਦਾ ਭੱਜ ਦੌੜ ਕੇ ਮੇਰਾ ਪਸੀਨਾ ਤੇ ਪਸੀਨਾ ਆ ਕੇ ਥੱਕ ਨਿਕਲ ਜਾਵੇ ਤੇ ਮੈਂ ਪੱਖੇ ਥੱਲੇ ਬਹਿ ਕੇ ਕੱਢ ਫਿਰ ਪਾਣੀ ਪੀਦਾ ਕਿਉਂਕਿ ਇੱਕ ਮੈਂ ਸਿਖਲਾਈ ਲੈਤੀ ਹੋਈ ਆ ਦੌੜਨ ਦੀ ਕਿਉਂਕਿ ਮੈਨੂੰ ਪਤਾ ਹੈ ਕਿ ਇੱਕ ਸਿਖਲਾਈ ਦੇ ਦੌਰਾਨ ਕੀ ਸਾਨੂੰ ਭੱਜਿਆ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਜੋ ਕਿ ਸਰੀਰ ਦੇ ਲਈ ਹਾਨੀਕਾਰਕ ਹੁੰਦਾ ਮੈਂ ਹਾਈਡਰੇਸ਼ਨ ਵੀ ਦੂਰ ਕਰਨ ਲਈ ਗੁਲੂਕੋਨ ਡੀ ਪਾਣੀ ਪੀਨਾ ਮੈਂ ਸਿਖਲਾਈ ਲੈਤੀ ਸੀ ਕੀ ਸਾਨੂੰ ਭੱਜਣ ਤੋਂ ਬਾਅਦ ਗਲੂਕੋਨ ਡੀ ਪਾਣੀ ਪੀਣਾ ਚਾਹੀਦਾ ਤਾਂ ਕਿ ਸਾਡੇ ਸਰੀਰ ਨੂੰ ਹਾਈਡਰੋਜਨ ਦੀ ਕਮੀ ਨਾ ਹੋਵੇ ਕਿਉਂਕਿ ਜਦੋਂ ਅਸੀਂ ਭੱ ਇੱਕ ਪ੍ਰੋਪਰ ਸਿਖਲਾਈ ਅਤੇ ਦੌੜ ਦੇ ਵਿੱਚ ਪੋਸ਼ਣ ਆਦੀ ਵਧੀਆ ਹੋਊਗਾ ਤੇ ਸਾਡੀ ਸਾਨੂੰ ਇੱਕ ਨਵੀਂ ਊਰਜਾ ਮਹਿਸੂਸ ਹੋਗੀ ਸਾਨੂੰ ਦਿਨ ਵਿੱਚ ਕੰਮ ਕਰਨ ਵਿੱਚ ਬਹੁਤ ਹੀ ਜਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਗੀ ਇਹ ਸਾਡੇ ਖੁਸ਼ੀ ਗਮੀ ਚਿਹਰੇ ਆਦੀ ਨੂੰ ਸਾਫ ਮੂੰਹ ਵਿੱਚ ਹੀ ਦਿਖਾ ਦੇਵੇਗੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਲਾ ਵਿਚ ਘੜਾ ਜਿਵੇਂ ਅਸੀਂ ਦੋੜਦੇ ਹਾਂ ਤਾਂ ਇਹ ਮਨ ਨੂੰ ਸ਼ਾਂਤ ਕਰਦਾ ਤੇ ਤਾਂ ਲੱਛਣ ਘਟਾਉਂਦਾ ਇਹ ਸਦਾ ਇੱਕ ਸਾਡੇ ਪ੍ਰੋਪਰ ਮਾਪਣ 'ਚ ਪੋਸ਼ਨ ਤੇ ਹਾਈਡਰੋਸ਼ਨ ਦੇ ਰਾਹੀਂ ਇਹੀ ਜਿਆਦਾ ਵਾਧਾ ਜਿਹੜਾ ਨਿਯਮ ਹ ਦੌੜਦੇ ਆਂ ਸਹੀ ਪੋਸ਼ਨ ਲੈਦੇ ਆ ਤੇ ਹਾਈਡਰੇਸ਼ਨ ਆਦੀ ਨੂੰ ਧਿਆਨ ਵਿੱਚ ਰੱਖਦੇ ਹ ਜਿਸ ਨਾ ਕਿਰਿਆਵਾਂ ਕਰਨ ਵਿੱਚ ਸਾਧ ਮਹਿਸੂਸ ਹੁੰਦਾ ਹੈ ਤੇ ਪ੍ਰੋਪਰ ਦੌੜ ਦੀ ਸਿਖਲਾਈ ਅਤੇ ਪੋਸ਼ਨ ਨਾਲ ਸਾਡਾ ਆਤਮ ਵਿਸ਼ਵਾਸ ਵੀ ਦਿਨੋ ਦਿਨ ਵੱਧਦਾ ਜਾਂਦਾ ਅਸੀਂ ਇੱਕ ਨਵਾਂ ਹੀ ਆਪਦੇ ਆਪ ਵਿੱਚ ਊਰਜਾ ਮਹਿਸੂਸ ਕਰਦੇ ਆ ਜਿਸ ਨਾਲ ਸਾਡਾ ਆਤਮ ਵਿਸ਼ਵਾਸ ਦਿਨੋ ਦਿਨ ਵੱਧਦਾ ਜਾਂਦਾ ਹੈ ਅਤੇ ਅਸੀਂ ਇਹ ਸਾਰਾ ਕੁਝ ਸਿਖਲਾਈ ਅਤੇ ਦੌੜ ਦੀ ਪੋਸ਼ਨ ਹਾਈਡਰੋਸ਼ਨ ਰਾਹੀਂ ਹੀ ਕਰ ਸਕਦੇ ਹਾਂ ਧੰਨਵਾਦ